ਪਕਵਾਨ ਬਣਾਉਣਾ ਮੇਰੀ ਇੱਕ ਹੋਬੀ ਹੈ ਅਸਲ 'ਚ ਮੇਰੇ ਮੰਮੀ ਤੋਂ ਮੈਨੂੰ ਇਹ ਗੁਣ ਮਿਲਿਆ ਹੈ ਉਹ ਬਹੁਤ ਹੀ ਵਧੀਆ ਕੁੱਕ ਹਨ ਅਤੇ ਬਹੁਤ ਹੀ ਤਰ੍ਹਾਂ ਦੀਆਂ ਡਿਸ਼ਿਜ਼ ਉਹਨਾਂ ਨੂੰ ਬਣਾਉਣੀਆਂ ਆਉਂਦੀਆਂ ਹਨ ਜੋ ਕਿ ਮੈਂ ਉਹਨਾਂ ਤੋਂ ਹੀ ਸਿੱਖੀਆਂ ਹਨ ਬਟ ਹੁਣ ਕਿਉਂਕਿ ਰੀਸੈਂਟਲੀ ਇਲੈਕ ਇੰਟਰਨੈੱਟ ਦਾ ਜ਼ਮਾਨਾ ਹੈ ਔਰ ਬਹੁਤ ਸਾਰੀਆਂ ਡਿਸ਼ਿਜ਼ ਦੀ ਜੋ ਰੈਸਪੀ ਹੈ ਉਹ ਇੰਟਰਨੈੱਟ 'ਤੇ ਬੜੀ ਆਸਾਨੀ ਨਾਲ ਮਿਲ ਜਾਂਦੀ ਆ ਸੋ ਉੱਥੋਂ ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਜੋ ਬਣਾਉਣੀਆਂ ਸਿੱਖੀਆਂ ਹਨ ਸੋ ਮੇਰੇ ਅਨੁਭਵ ਦੇ ਅਕੋਡਿੰਗ ਜੋ ਸਭ ਤੋਂ ਔਖੀ ਚੀਜ਼ ਜਿਹੜੀ ਮੈਨੂੰ ਬਣਾਉਣ ਲੱਗੀ ਸੀਗੀ ਸਭ ਤੋਂ ਪਹਿਲੀ ਵਾਰ ਉਹ ਮੈਨੂੰ ਕੜਾਹੀ ਪਨੀਰ ਲੱਗਿਆ ਸੀਗਾ ਬਣਾਉਣਾ ਕਿਉਂਕਿ ਉਹਦੇ ਵਿੱਚ ਕਾਫੀ ਸਾਰੇ ਸਪਾਈਸਿਜ਼ ਜੋ ਮੇਰੇ ਪਾਸ ਉਸ ਟਾਈਮ ਅਵੇਲੇਬਲ ਨਹੀਂ ਸੀਗੇ ਸੋ ਉਹਨਾਂ ਨੂੰ ਅਰੇਂਜ ਕਰਨਾ ਮੈਨੂੰ ਕਾਫੀ ਡਿਫੀਕਲਟ ਲੱਗਿਆ ਔਰ ਉਸ ਤੋਂ ਬਾਅਦ ਇੱਕ ਟੇਸਟ ਦੇ ਵਿੱਚ ਕਨਸਿਸਟੈਂਸੀ ਲੈ ਕੇ ਆਉਣ ਲਈ ਉਸਨੂੰ ਸਲੋਅ ਕੁੱਕਰ ਨਾਲ ਉਸ 'ਚ ਡਿਫਰੈਂਟ ਸਪਾਈਸਜ਼ ਇੱਕ ਡਿਫਰੈਂਟ ਡਿਫਰੈਂਟ ਟਾਈਮ 'ਤੇ ਉਹਨਾਂ ਨੂੰ ਐਡ ਕਰਨਾ ਤਾਂ ਕਿ ਹਰ ਇੱਕ ਸਪਾਈਸ ਦਾ ਸ ਜੋ ਫਲੇਵਰ ਹੈ ਉਹ ਬੜੇ ਅੱਛੇ ਤਰੀਕੇ ਨਾਲ ਆਵੇ ਅਤੇ ਬਿਲਕੁਲ ਸਹੀ ਕੁਆਂਟਿਟੀ ਦੇ ਵਿੱਚ ਉਹਨਾਂ ਨੂੰ ਪਾਉਣਾ ਸੋ ਮੇਰੇ ਲਈ ਇੱਕ ਬਹੁਤ ਵੱਡਾ ਚੈਲੇਂਜ ਸੀਗਾ ਜਦੋਂ ਮੈਂ ਸਭ ਤੋਂ ਪਹਿਲੀ ਵਾਰ ਇਹ ਡਿਸ਼ ਟਰਾਈ ਕੀਤੀ ਸੀਗੀ ਔਰ ਸਭ ਤੋਂ ਆਸਾਨ ਮੈਨੂੰ ਲੱਗਿਆ ਸੀਗਾ ਗੁਲਾਬ ਜਾਮੁਨ ਬਣਾਉਣਾ ਜੋ ਕਿ ਬਹੁ ਮੇਰੀ ਇੱਕ ਫੇਵਰੇਡ ਸਵੀਟ ਹੈ ਸੋ ਜਦੋਂ ਮੈਂ ਫਸਟ ਟਾਈਮ ਗੁਲਾਬ ਜਾਮੁਨ ਬਣਾਉਣਾ ਸ਼ੁਰੂ ਕੀਤਾ ਸੀਗਾ ਉਹਨੂੰ ਟਰਾਈ ਕੀਤਾ ਸੀਗਾ ਸੋ ਉਹਦੀ ਮੈਂ ਰੈਸਪੀ ਯੂਟਿਊਬ ਤੋਂ ਦੇਖੀ ਸੀਗੀ ਔਰ ਉਸ ਤੋਂ ਬਾਅਦ ਮੈ ਉਹਨੂੰ ਟਰਾਈ ਜਦੋਂ ਕੀਤਾ ਤਾਂ ਉਹ ਬਹੁਤ ਹੀ ਆਸਾਨ ਲੱਗੀ ਮੈਨੂੰ ਕਿ ਜਿਵੇਂ ਤੁਸੀਂ ਸਿਰਫ ਫੁਲਾਉਣ ਨੂੰ ਜਾਂ ਜੋ ਖੋਇਆ ਹੁੰਦਾ ਹੈ ਉਹਦੇ ਨਾਲ ਹੀ ਤੁਸੀਂ ਕਿਵੇਂ ਗੁਲਾਬ ਜਾਮੁਨ ਬਣਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸੂਜੀ ਦੇ ਬ੍ਰੈਡ ਦੇ ਜਾਂ ਫੇਰ ਪਾਊਡਰ ਮਿਲਕ ਦੇ ਗੁਲਾਬ ਜਾਮੁਨਸ ਮੈਂ ਇਹ ਸਾਰੀ ਤਰ੍ਹਾਂ ਦੇ ਗੁਲਾਬ ਜਾਮੁਨਸ ਟਰਾਈ ਕੀਤੇ ਸੀ ਬਣਾਉਣੇ ਔਰ ਬਣਾਉਣ ਤੋਂ ਬਾਅਦ ਹਰ ਇੱਕ ਗੁਲਾਬ ਜਾਮੁਨ ਦਾ ਆਪਣਾ ਇੱਕ ਟੇਸਟ ਸੀਗਾ ਔਰ ਉਹਦੀ ਜੋ ਆਪਣੀ ਇੱਕ ਸੋਫਟਨੈੱਸ ਸੀਗੀ ਜੋ ਕਿ ਬਿਲਕੁਲ ਨਹੀਂ ਸੀ ਲੱਗਦਾ ਕਿ ਉਹ ਸਾਰੇ ਗੁਲਾਬ ਜਾਮੁਨਸ ਘਰ ਬਣਾਏ ਗਏ ਹਨ ਸੋ ਮੈਂ ਕਹਿ ਸਕਦੀ ਹਾਂ ਕਿ ਸ਼ਾਹੀ ਪਨੀਰ ਮੈਨੂੰ ਬਹੁਤ ਔਖਾ ਲੱਗਿਆ ਸੀਗਾ ਬਣਾਉਣਾ ਬਟ ਗੁਲਾਬ ਜਾਮੁਨ ਮੈਨੂੰ ਬਹੁਤ ਸੌਖੀ ਲੱਗੀ ਸੀਗੀ ਸੋ ਬਟ ਇਹਨਾਂ ਦੋਨਾਂ ਦਾ ਅਨੁਭਵ ਮੇਰੇ ਲਈ ਇੱਕ ਵੱਖਰਾ ਹੀ ਸੀ ਕਿਉਂਕਿ ਕੋਈ ਵੀ ਚੀਜ਼ ਜਦੋਂ ਆਪਾਂ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਟੇਸਟ ਦਾ ਜਾਂ ਸਪਾਈਸਿਜ਼ ਦਾ ਕਿਸੇ ਵੀ ਤਰ੍ਹਾਂ ਦਾ ਸੋ ਉਸ ਚੀਜ਼ ਨੂੰ ਬੈਲੇਂਸ ਕਿਵੇਂ ਕਰਨਾ ਹੈ ਸੋ ਉਹ ਸਾਰੇ ਹੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ